ਹੈਲੋ ਹੋਰ ਦਿਲਪ੍ਰੀਤ ਸਿੰਘ ਕੀ ਹਾਲ ਆ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾ ਕੀ ਕਰਦਾ ਸੀ ਅੱਛਾ ਉਹ ਤਾਂ ਫਸਲ ਫੁਸਲ ਕੱਟ ਲਈ ਹੁਣ ਤਾਂ ਵਿਹਲੇ ਹੋ ਗਏ ਹੋਵੋਗੇ ਅੱਛਾ ਹਜੇ ਵੱਢ ਰਹੇ ਹੋ ਅੱਛਾ ਕਿੰਨੀ ਕੁ ਕਰ ਲਈ ਕਿੰਨੇ ਕੁ ਕਿੱਲੇ ਵੱਢ ਲਏ ਅੱਛਾ ਕਿੰਨੇ ਕੁ ਤੁਹਾਡੀ ਦਸ ਕਿੱਲੇ ਜਮੀਨ ਹੈ ਤੁਹਾਡੀ ਤਾਂ ਬਸ ਛੇ ਕਿੱਲੇ ਰਹਿ ਗਏ ਚੱਲ ਲੱਗੇ ਰਹੋ ਵਧੀਆ ਮਸ਼ੀਨ ਦਾ ਐਤਕੀ ਫਸਲ ਕਿਹੋ ਜਿਹੀ ਹੋ ਗਈ ਫਸਲ ਕਿਹੋ ਜਿਹੀ ਹੋ ਗਈ ਐਤਕੀ ਹੋਰ ਉਹ ਹੀ ਹੈ ਹੁਣ ਮੌਸਮ ਬਦਲਦੀ ਗਰਮੀ ਵਧਣ ਕਰਕੇ ਸਾਰਾ ਦਿੱਕਤ ਆ ਰਹੀ ਆ ਸਾਡੀ ਤਾਂ ਆਪਦੀ ਫਸਲ ਦਾ ਜਲੂਸ ਨਿਕਲ ਗਿਆ ਭਰਾਵਾਂ ਕੀ ਦੱਸੀਏ ਤੈਨੂੰ ਪਿਛਲੀ ਵਾਰ ਹੋਰ ਪੰਦਰਾਂ ਕਿੱਲੇ ਸੀਗੇ ਉਹਦੇ ਵਿੱਚੋਂ ਮੀਂਹ ਪੈ ਗਿਆ ਹੱਦ ਪੰਜ ਕਿੱਲੇ ਜਮਾਂ ਹੀ ਖ਼ਰਾਬ ਨਿਕਲ ਗਏ ਸਾਰੀ ਫਸਲ ਖ਼ਰਾਬ ਹੋ ਗਈ ਉਹ ਚੋਂ ਤਾਂ ਉਹ ਬਾਕੀ ਜਿਹੜੀ ਸੀ ਉਹ ਅੱਧੀ ਤੋਂ ਜ਼ਿਆਦਾ ਫਸਲ ਥੱਲੇ ਵਿਛ ਗਈ ਉਹ ਕੰਬਾਈਨ ਦਾ ਇੰਨਾ ਜ਼ਿਆਦਾ ਜੋਰ ਲੱਗ ਗਿਆ ਜਿੱਥੇ ਉਹਦਾ ਤੇਲ ਲੱਗਣਾ ਸੀਗਾ ਉਹਦਾ ਦੁੱਗਣਾ ਤੇਲ ਲਾ ਗਈ ਉਹ ਉੰਨਾ ਪੈਸਾ ਪੀਗੀ ਉਹਦਾ ਤੇਲ ਲਈ ਹੋਰ ਫਿਰ ਜਦੋਂ ਜਾ ਕੇ ਮੰਡ ਹੋਰ ਇਹ ਹੀ ਪੰਗਾ ਪੈ ਗਿਆ ਫਿਰ ਜਦੋਂ ਜਾ ਕੇ ਮੰਡੀ 'ਚ ਰੇਟ ਮੰਗਿਆਂ ਉਹਦਾ ਰੇਟ ਨੂੰ ਮਨ ਉਹ ਹੀ ਕਰਨ ਲੱਗ ਗਏ ਫਸਲ ਵਧੀਆ ਨਹੀਂ ਹੋਈ ਹੀ ਤੁਹਾਡੀ ਅਸੀਂ ਅਸੀਂ ਕਿਵੇਂ ਰੇਟ ਦੇ ਦੇਈਏ ਇਹਦਾ ਹੋਰ ਫਿਰ ਮੈਂ ਦਸ ਰੁਪਏ ਕਿੱਲੋ ਨੂੰ ਫਸਲ ਵੇਚ ਕੇ ਆਇਆ ਰੋ ਪਿੱਟ ਕੇ ਉਹ ਤਾਂ ਸੱਤ ਕਹਿੰਦੇ ਸੀਗੇ ਮੈਂ ਕਿਹਾ ਲੜਾ ਪਿੱਟ ਕੇ ਉਥੀ ਸੱਤ ਕ ਰੁਪਏ ਕਿੱਲੋ ਮੈਂ ਹੁਣ ਕੀ ਕਰੂਗਾਂ ਵੀਹ ਕੁਇੰਟਲ ਫਸਲ ਹੋਈ ਸੀ ਜਮਾਂ ਸਾਰੀ ਹੋਰ ਬਹੁਤ ਬਹੁਤ ਜ਼ਿਆਦਾ ਘਾਟਾ ਪੈ ਗਿਆ ਐਤਕੀ ਤਾਂ ਹੋਰ ਕੁਛ ਵੀ ਨਹੀਂ ਬਣਿਆ ਹੈਗਾ ਹੋਰ ਹੁਣ ਬੰਦਾ ਦੱਸ ਕੀ ਕਰੇ ਇੱਥੇ ਕਿੱਧਰ ਨੂੰ ਜਾਊਗਾ ਇੰਨੀ ਕੁ ਫਸਲ ਕਰਕੇ ਉਹਨੂੰ ਪੈਸੇ ਵੀ ਕੀ ਬਣਾਵੇ ਬੰਦਾ ਇੰਨੇ ਨਾਲ ਮੁੜ ਕੇ ਸਾਲੇ ਸਾਡੇ ਤਾਂ ਆਪ ਘਰੇ ਵਿਆਹ ਵਿਆਹ ਆਉਂਦਾ ਜਾਂਦਾ ਹੋਰ ਜਿੰਨੇ ਤਾਂ ਇੰਨੇ ਕੁ ਤਾਂ ਮਸ਼ੀਨ 'ਚ ਤੇਲ ਲੱਗ ਜਾਂਦਾ ਜਿੰਨੇ ਕੁ ਐਤਕੀ ਬਣੇ ਆ ਐਤਕੀ ਤਾਂ ਫਸਲ ਵਾਹਲੀ ਜ਼ਿਆਦਾ ਡੁੱਬ ਗਈ ਵਾਹਲਾ ਬੁਰਾ ਹਾਲ ਹੋ ਗਿਆ ਐਤਕੀ ਤਾਂ ਹੋਰ ਤਾਂ ਸੱਚੀਂ ਰੋਣਾ ਹੀ ਆ ਰਿਹਾ ਵੀ ਐਤਕੀ ਕਰਾਂਗੇ ਕੀ ਹੁਣ ਮੈਂ ਕਿਹਾ ਵਿਆਹ ਵੀ ਆ ਰਿਹਾ ਕੁੜੀ ਦਾ ਉਹ ਵੀ ਭੁਗਤਾਣਾ ਹਜੇ ਨਾ ਕਰਾਏ ਹੋਰ ਲੋਨ ਮੰਗਦਾ ਲੋਨ ਦੇ ਤਾਂ ਪੰਗਾ ਵੀ ਲੋਨ ਮੰਗ ਕੇ ਜਾਵਾਂਗੇ ਕਿੱਧਰ ਨੂੰ ਮੁੜ ਕੇ ਪੂਰਾ ਨਾ ਹੋਇਆ ਹੈਗਾ ਫੇਰ ਉਹ ਏਜੰਟਾਂ ਦੇ ਪੰਗੇ ਸਿਰ ਨੂੰ ਪੈ ਜਾਣਾ ਉਹਨਾਂ ਨੇ

ਹੋਰ ਬਾਕੀ ਦੇਖਦੇ ਲੋੜ ਪਈ ਭਰਾ ਮੇਰੀ ਮਾੜੀ ਜੀ ਮਦਦ ਕਰਦੀ ਪਰ ਤੇਰੀ ਐਸੀ ਵੈਸੀ ਹੋਈ ਆ ਮੈਨੂੰ ਵੀ ਪਤਾ ਪਰ ਫਿਰ ਵੀ ਮਾੜੀ ਮੋਟੀ ਕਰਦੀ ਮਦਦ ਹਾਂ ਮੈਨੂੰ ਮਾੜਾ ਜਿਹਾ ਸੌਖਾ ਹੋ ਜੂਗਾ ਚੱਲ ਮੈਨੂੰ ਬੁਲਾਉਂਦੇ ਸੀ ਤੈਨੂੰ ਮੈਂ ਲਾਉਂਦਾ ਠੀਕ ਹੈ ਓਕੇ